ਬੁੱਲੇ ਸ਼ਾਹ ਜੀ ਦੀਆਂ ਰਚਨਾਵਾਂ ਸਧਾਰਨ ਬੋਲ ਚਾਲ ਦੀ ਪੰਜਾਬੀ ਚ ਲਿਖੀਆਂ ਗਈਆਂ ਹਨ ਇਸ ਸੰਦਾ ਸਧਾਰਨਤਾ ਨੇ ਮੇਰੀ ਲਿਖਤ ਨੂੰ ਪ੍ਰੇਰਿਤ ਕੀਤਾ ਹੈ ਅਤੇ ਮੇਰੀ ਭਾਸ਼ਾ ਪਾਠਕਾਂ ਲਈ ਆਸਾਨ ਅਤੇ ਗਹਿਰਾਈ ਵਾਲੀ ਹੋਵੇ ਉਹਨਾਂ ਦੀਆਂ ਕਵਿਤਾਵਾਂ ਸਮਾਜ ਵਿੱਚ ਵੰਡੇ ਗਏ ਧਾਰਮਿਕ ਜਾਤੀਵਾਦ ਅਤੇ ਸਿਆਸੀ ਪੱਖਾਂ ਨੂੰ ਚੁਣੌਤੀ ਦਿੰਦੀਆਂ ਹਨ ਬਾਬਾ ਬੁੱਲੇ ਸ਼ਾਹ ਜੀ ਦੇ ਬਾਬਾ ਬੁੱਲੇ ਸ਼ਾਹ ਨੇ ਮਨੁੱਖ ਦੇ ਆਤਮਿਕ ਵਿਕਾਸ ਰੂਹਾਨੀ ਯਾਤਰਾ ਰੱਬ ਨਾਲ ਮੇਲ ਮਿਲਾਪ ਦੀ ਗੱਲ ਕੀਤੀ ਹ ਤੇ ਕਿਹਾ ਕਿ ਸਾਨੂੰ ਸਭ ਨਾਲ ਪਿਆਰ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਅਤੇ ਬਾਬਾ ਬੁੱਲੇ ਸ਼ਾਹ ਜੀ ਨੇ ਜਮਾਨੇ ਦੀ ਰਵਾਇਤੀ ਧਾਰਮਿਕ ਪੱਖਾਂ ਦਾ ਵਿਰੋਧ ਕੀਤਾ ਹੈ ਇਹ ਮੈਨੂੰ ਸਿਖਾਉਂਦਾ ਹੈ ਕਿ ਜਿਵੇਂ ਸੱਚਾਈ ਲਈ ਕਦੇ ਵੀ ਡਰਨਾ ਨੀ ਚਾਹੀਦਾ ਇਨਸਾਨੀ ਬਰਾਬਰੀ ਨਾਲ ਪ੍ਰਭਾਵਿਤ ਕੀਤਾ ਧਰਮ ਅਤੇ ਸੱਚਾਈ ਦੀ ਖੋਜ ਕੀਤੀ ਹ ਜਮੀਨੀ ਸੱਚਾਈਆ ਮੈਨੂੰ ਪ੍ਰੇਰਨਾ ਦਿੰਦੀਆਂ ਹਨ ਕਿ ਲਿਖਤ ਵਿੱਚ ਲੋਕਾਂ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਦਰਸਾਵਾਂ ਤੇ ਰੂਹਾਨੀ ਪਿਆਰ ਉਹਨਾਂ ਦੀਆਂ ਕਵਿਤਾਵਾਂ ਮੇਰੀਆਂ ਕਵਿਤਾਵਾਂ ਵਿੱਚ ਗਹਿਰਾਈ ਅਤੇ ਸਿਧਾਂਤਾਂ ਲਿਆਉਂਦੀਆਂ ਹਨ